ਹਾਂਜੀ ਮੈਮ ਕਿਵੇਂ ਹੋ ਅੱਛਾ ਅੱਛਾ ਕਿਉਂ ਕੀ ਹੋਇਆ ਅੱਛਾ ਮੌਸਮ ਤਾਂ ਇਸ ਵਾਰੀ ਜ਼ਿਆਦਾ ਖਰਾਬ ਸੀ ਨਾਲੇ ਹੜ੍ਹ ਹੁੜ੍ਹ ਵੀ ਆਏ ਸੀਗੇ ਅੱਛਾ ਵਧੀਆ ਬੀਜ ਉਹ ਐਚ ਆਈ ਵੀ ਤਾਂ ਨੱ ਉੱਨੀ ਸੌ ਰੁਪਏ ਕਿਲੋ ਆਉਂਦੇ ਹਨ ਉਹ ਲੈ ਲੈਣੇ ਸੀ ਉਸਦੇ ਨਾਲ ਫਸਲ ਦੀ ਪੈਦਾਵਾਰ ਵੀ ਵਧਦੀ ਹੈ ਇਹ ਗ੍ਰੀਨ ਰੈ ਲ ਰੈਵੋਲਊਸ਼ਨ ਵੀ ਕਿਸਾਨਾਂ ਕਰਕੇ ਸ਼ੁਰੂ ਹੋਇਆ ਸੀ ਜਿਸ ਨਾਲ ਇੱਕ ਬੜੀ ਤਬਦੀਲੀ ਹੋਈ ਸੀ ਇਸ ਤਬਦੀਲੀ ਦਾ ਸੰਬੰਧ ਉਪਜਾਊ ਬੀਜ ਕਿਸਾਨ ਦੀਆਂ ਜ਼ਮੀਨਾਂ ਦੇ ਸੁਧਾਰ ਔਰਤਾਂ ਦੀ ਤਕਨੀਕ ਅਤੇ ਨਵੀਂ ਨੂੰ ਸ਼ਾਮਿਲ ਕਰਦਾ ਹੈ ਇਸ ਸਾਲ ਕਿਸਾਨਾਂ ਦੀ ਉਤਪਾਦਨ ਵਧੇਰੇ ਅਤੇ ਭਾਵ ਵਧੇਰੇ ਨਾਲ ਗਿਆ ਹੈ ਅੰਤ ਇਸ ਦੇ ਨਾਲ ਨ ਨਵੀਂ ਤਕਨੀਕਾਂ ਵੀ ਸਾਹਮਣੇ ਆਈਆਂ ਹਨ ਇਸ ਤਰੀਕੇ ਦੇ ਦੌ ਦੌਰਾਨ ਖੇਤੀ ਵਿੱਚ ਉਤਪਾਦਨਸ਼ੀਲਤਾ ਇਨਵੋ ਇਨੋ ਇਨੋਵੇਸ਼ਨ ਦਾ ਵਿਸ਼ੇਸ਼ ਤਰੀਕਾ ਬਣ ਬਣਿਆ ਗਿਆ ਹੈ ਅਤੇ ਕਿਸਾਨਾਂ ਲਈ ਨਵੇਂ ਸੰਦੇਸ਼ ਅਤੇ ਅਵਸਰ ਲਾਇਆ ਹੈ ਇਹ ਇਸ ਵਿੱਚ ਮੈਮ ਐਚ ਵਾਈ ਸੀਡ ਐਚ ਵਾਈ ਵੀ ਸੀਡ ਦੀ ਵੀ ਵਰਤੋਂ ਹੁੰਦੀ ਹੈ ਜਿਸ ਨਾਲ ਬਹੁਤ ਹੀ ਘੱਟ ਘੱਟ ਬੀਜ 'ਚ ਵਧੀਆ ਫਸਲ ਉੱਗਦੀ ਹੈ ਇਹ ਬੀਜ ਸ਼ੁੱਧ ਅਤੇ ਪ੍ਰਭਾਵੀ ਵੀ ਹੁੰਦੇ ਹਨ ਜੋ ਕਿ ਖੇਤੀ ਦੀ ਉਤਪਾਦਨਸ਼ੀਲਤਾ ਨੂੰ ਵਧਾਉਂਦੇ ਹਨ ਇਹ ਬੀਜ ਕਿਸਾਨਾਂ ਨੂੰ ਜਾਣ ਵਧੇਰੇ ਤਕ ਤਕ ਤਕਨੀਕੀ ਜਾਣਕਾਰੀ ਦੀ ਪ੍ਰਾਪਤੀ ਕੁਝ ਉਪਜ ਅਤੇ ਕਮੀਆਂ ਨੂੰ ਮਿਟਾਉਣ ਲਈ ਸਹਾਇਤਾ ਵੀ ਕਰਦੇ ਹਨ ਇਹ ਬੀਜ ਨਵੇਂ ਖੇਤੀ ਤਕਨੀਕੀ ਅਤੇ ਰੋਜ਼ਾਨਾ ਦੀ ਵਰਤੋਂ ਬਦਲਵੇਂ ਸਹਾਇਕ ਹੁੰਦੇ ਹਨ ਇਹ ਇਸ ਬੀਜ ਨੂੰ ਅਧਿਕ ਮਾਈਕਰੋ ਮਾਈਕਰੋ ਪੋਟਾਸ਼ੀਅਮ ਅਤੇ ਅਤੇ ਹੋਰ ਵੀ ਕੈਮਿਕਲ ਕੈਮੀਕਲਾਂ ਨਾਲ ਬਲਾ ਬਣਾਇਆ ਜਾਂਦਾ ਹੈ ਜਿਸ ਜੋ ਫਸਲਾਂ ਦੀ ਪੈਦਾਵਾਰ ਨੂੰ ਵਧਾਉਂਦਾ ਹੈ ਅੱਛਾ ਇਹ ਇ ਇਸਦੀ ਇਸਦੀ ਕਮੀਆਂ ਬਹੁਤ ਘੱਟ ਹਨ ਇਹ ਜ਼ਿਆਦਾ ਇਹ ਬਸ ਮਿੱਟੀ ਦੀ ਮਿੱਟੀ ਮਿੱਟੀ ਦੀ ਵਰ ਸ਼ਕਤੀ ਨੂੰ ਘਟਾਉਂਦਾ ਹੈ ਹੋਰ ਬਾਕੀ ਇਹ ਵਧੀਆ ਹੈ ਅਤੇ ਨਾਲੇ ਫਸਲ ਨੂੰ ਵੀ ਵਧੀਆ ਬਣਾਉਂਦਾ ਹੈ ਅਤੇ ਝਾੜ ਵੀ ਘੱਟ ਉਗਾਉਂਦਾ ਹੈ ਹਾਂਜੀ ਇਸਦੀ ਉਨ ਇਸ ਦੇ ਨਾਲ ਕਿਸਾਨਾਂ ਦੀ ਕਾਫੀ ਉੱਨਤੀ ਹੋਈ ਹੈ ਅਤੇ ਭੁੱਖਮਰੀ ਵੀ ਬਹੁਤ ਘਟੀ ਹੈ ਸਾਨੂੰ ਵ ਸਾਨੂੰ ਹਮੇਸ਼ਾ ਗਰੀਨ ਸੀਡ ਚੰਗੇ ਬੀਜਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਇਸਦੇ ਨਾਲ ਇਹ ਇਸ ਦੀਆਂ ਮਾੜੀਆਂ ਚੀਜ਼ਾਂ ਬਹੁਤ ਘੱਟ ਨੇ ਇਹ ਇਹ ਬਸ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾਉਂਦਾ ਹੈ ਅਤੇ ਮੈਮ ਹੋਰ ਕੁਛ ਤਾਂ ਨਹੀਂ ਪ੍ਰੋਬਲਮ ਓਕੇ ਓਕੇ